ਹਾਂਜੀ ਠੀਕ ਹੈ ਠੀਕ ਹੈ ਜੀ ਕੁਲਜੀਤ ਜੀ ਕੀ ਹਾਲ ਆ ਹਾਂ ਵਧੀਆ ਜੀ ਆਪਣੇ ਦੱਸੋ ਕਿਵੇਂ ਠੀਕ ਆ ਸਾਰੇ ਫਸਲ ਠੀਕ ਸੀ ਹਾਂਜੀ ਫਸਲ ਠੀਕ ਸੀ ਹਾਂਜੀ ਵਧੀਆ ਸੀ ਠੀਕ ਠਾਕ ਰਹੀ ਹਰ ਤਰ੍ਹਾਂ ਦੀ ਤਰ੍ਹਾਂ ਤੁਹਾਨੂੰ ਪਤਾ ਬਸ ਖੇਤੀ ਦੇ ਹਾਲ ਤੁਹਾਨੂੰ ਹਾਂਜੀ ਹਾਂਜੀ ਅੱਛਾ ਠੀਕ ਹੈ ਗਰੀਨ ਐਬੁਲੇਸ਼ਨ ਹਾਂਜੀ ਪੰਜਾਬੀ ਵਿੱਚ ਹਰੀ ਕ੍ਰਾਂਤੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਪੁੱਛੋ ਕੋਈ ਗੱਲ ਨਹੀਂ ਹਾਂਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਗ੍ਰੀਨ ਰੈਵੋਲਊਸ਼ਨ ਹੈ ਠੀਕ ਹੈ ਜੀ ਹੈ ਨਾ ਪੰਜਾਬੀ 'ਚ ਉਹਨੂੰ ਆਪਾਂ ਕਹਿ ਦਿੰਦੇ ਹਾਂ ਹਰੀ ਕ੍ਰਾਂਤੀ ਇਹ ਇੰਡੀਆ ਦੇ ਵਿੱਚ ਨਾ ਭੋਜਨ ਦੀ ਮੰਗ ਪੂਰੀ ਕਰਨ ਲਈ ਆਪਣਾ ਉੱਨੀ ਸੌ ਸੱਠ ਅਤੇ ਸੱਤਰ ਦੇ ਦਹਾਕੇ ਦੇ ਵਿੱਚ ਜਿਹੜੀ ਖੇਤੀ ਹੈ ਨਾ ਖੇਤੀ ਖੇਤਰ ਵਿੱਚ ਆਈ ਸੀ ਨਾ ਕ੍ਰਾਂਤੀ ਉਹਨੂੰ ਕਿਹਾ ਜਾਂਦਾ ਸੀਗਾ ਗਰੀਨ ਰੈਵਲਿਊਸ਼ਨ ਹਾਂਜੀ ਅਤੇ ਇਸ ਕਰਕੇ ਆਪਣੇ ਉਸ ਟਾਈਮ 'ਤੇ ਪੰਜਾਬ ਨੂੰ ਹਰੀ ਕ੍ਰਾਂਤੀ ਲਈ ਚੁਣਿਆ ਗਿਆ ਸੀ ਹਾਂ ਹਾਂਜੀ ਪੰਜਾਬ ਦਾ ਰੋਲ ਮੇਨ ਹੀ ਆ ਜੀ ਇੱਕ ਹਿਸਾਬ ਦਾ ਆਪਣਾ ਪੰਜਾਬ ਹਾਂਜੀ ਗ੍ਰੀਨ ਰੈਵੋਲਊਸ਼ਨ ਦੇ ਵਿੱਚ ਹਾਂ ਕਿਉਂਕਿ ਪੰਜਾਬੀਆਂ ਕੋਲ ਭ ਭਰਪੂਰ ਮਾਤਰਾ ਦੇ ਵਿੱਚ ਉਦੋਂ ਆਪਣਾ ਪਾਣੀ ਹੈ ਨਾ ਵੀ ਉਪਜਾਊ ਮਿੱਟੀ ਬਹੁਤ ਵਧੀਆ ਹੁੰਦੀ ਸੀਗੀ ਕਿਉਂਕਿ ਪਾਣੀ ਹਾਂਜੀ ਹਾਂਜੀ ਅਤੇ ਉਹੀ ਪਾਣੀ ਆਪਣਾ ਬਹੁਤ ਵਧੀਆ ਸੀ ਪੰਜਾਬ ਦਾ ਜਿਹਦੇ ਕਰਕੇ ਪਾਣੀ ਦੇ ਨਾਲ ਹੀ ਵਧੀਆ ਪੈਦਾਵਾਰ ਹੁੰਦੀ ਆ ਤੁਹਾਨੂੰ ਪਤਾ ਹਾਂਜੀ ਹਾਂਜੀ ਹਾਂਜੀ ਅਤੇ ਬਾਕੀ ਥੋੜ੍ਹਾ ਬਹੁਤ ਇਹਦਾ ਇਤਿਹਾਸ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦਾ ਵਾਂ ਮੈਂ ਤੁਹਾਨੂੰ ਤਾਂ ਵੀ ਇਹ ਮਤਲਬ ਉੱਨੀ ਸੌ ਸੱਠ ਦੇ ਵਿੱਚ ਨਾ ਜਿਹੜਾ ਆਪਣਾ ਭਾਰਤ ਸੀਗਾ ਉੱਨੀ ਸੌ ਸੱਠ ਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਖਾਸ ਕਰਕੇ ਜਿਵੇਂ ਅਮਰੀਕਾ ਹੋ ਗਿਆ ਨਾ ਅਮਰੀਕਾ ਤੋਂ ਅਨਾਜ ਜਿਹੜਾ ਸੀਗਾ ਉਹ ਆਪਣਾ ਕਰਦਾ ਹੁੰਦਾ ਸੀ ਦਰਾਮਦ ਕਰਦਾ ਹੁੰਦਾ ਸੀ ਹਾਂ ਮੰਗਾਉਂਦੇ ਹੁੰਦੇ ਸੀਗੇ ਅਤੇ ਫਿਰ ਉੱਨੀ ਸੌ ਤ੍ਰੇਂਹਠ ਤ੍ਰੇਂਹਠ ਦੇ ਵਿੱਚ ਭਾਰਤ ਨੇ ਹੈ ਨਾ ਪੰਜਾਹ ਲੱਖ ਟਨ ਅਨਾਜ ਜਿਹੜਾ ਸੀਗਾ ਉਹ ਦਰਾਮਦ ਕੀਤਾ ਸੀ ਹਾਂ ਬਸ ਇਤਿਹਾਸ ਇਹਦਾ ਨਾ ਨਾ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਹਾਂ ਕਿਉਂਕਿ ਨਾ ਹੁਣ ਲੋਕਾਂ ਨੇ ਖਾਦਾਂ ਪਾ ਪਾ ਰੇਹਾਂ ਸਪਰੇਆਂ ਪਾ ਪਾ ਅਤੇ ਜਿਹੜੀ ਆਪਣੀ ਜ਼ਮੀਨ ਦੀ ਪੈਦਾਵਾਰ ਆ ਮਿੱਟੀ ਦੀ ਉਪਜਾਊ ਸ਼ਕਤੀ ਮਾਰ ਦਿੱਤੀ ਜਮਾਂ ਜਿਹਦੇ ਕਰਕੇ ਕੀ ਆ ਨਾ ਨਾ ਬਿਲਕੁਲ ਜੀ ਹਾਂਜੀ ਹਾਂਜੀ ਇਸ ਕਰਕੇ ਕੀ ਹੈ ਜਿਹੜਾ ਹੁਣ ਆਪਣਾ ਇਹ ਪੰਜਾਬ ਫਿਰ ਬਹੁਤ ਪਿੱਛੇ ਹੋ ਗਿਆ ਇਹ ਚੀਜ਼ਾਂ ਨੂੰ ਲੈ ਕੇ ਬਾਕੀ ਕੋਈ ਗੱਲ ਨਹੀਂ ਤੁਸੀਂ ਇਹ ਜਾਣਕਾਰੀ ਜ਼ਰੂਰ ਸਾਂਝੀ ਕਰੋ ਜੀ ਅੱਗੇ ਠੀਕ ਹੈ ਜੀ ਠੀਕ ਠੀਕ ਹੈ